ਰੂਪਨਗਰ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਸੱਭਿਆਚਾਰਕ ਤਿਉਹਾਰ ਜਿਵੇਂ ਦੀਵਾਲੀ ਦੁਸਹਿਰਾ ਪੰਦਰਾਂ ਅਗਸਤ ਅਗਰ ਅਸੀਂ ਰਾਸ਼ਟਰੀ ਤਿਉਹਾਰ ਦੇਖੀਏ ਪੰਦਰਾਂ ਅਗਸਤ ਹੋ ਗਈ ਛੱਬੀ ਜਨਵਰੀ ਹੋ ਗਈ ਠੀਕ ਹੈ ਜੀ ਇਸ ਤੋਂ ਇਲਾਵਾ ਰੱਖੜੀ ਹੋ ਗਈ ਕਾਫੀ ਮਹੱਤਵਪੂਰਨ ਤਿਉਹਾਰ ਆ ਜਿਹੜੇ ਇੱਥੇ ਮਨਾਏ ਜਾਂਦੇ ਆ ਅਤੇ ਇਹਨਾਂ ਦਾ ਅਲੱਗ ਅਲੱਗ ਹੁੰਦਾ ਏ ਅਲੱਗ ਅਲੱਗ ਮਹੀਨੇ ਅਲੱਗ ਅਲੱਗ ਤਰੀਕਾਂ ਦੇ ਅਕੋਰਡਿੰਗ ਜਿਵੇਂ ਵੀ ਆਉਂਦੇ ਆ ਇਹ ਤਿਉਹਾਰ ਜਿਵੇਂ ਰੱਖੜੀ ਦਾ ਤਿਉਹਾਰ ਅਸੀਂ ਅਗਸਤ ਵਿੱਚ ਮਨਾਉਂਦੇ ਆ ਦੀਵਾਲੀ ਨਵੰਬਰ ਵਿੱਚ ਮਨਾਈ ਜਾਂਦੀ ਆ ਗੁਰਪੁਰਬ ਅਲੱਗ ਅਲੱਗ ਗੁਰੂ ਸਹਿਬਾਨਾਂ ਦੇ ਠੀਕ ਹੈ ਨਾ ਜਨਮ ਦਿਹਾੜੇ ਜਾਂ ਜਦੋਂ ਜੋਤੀ ਜੋਤ ਸਮਾਉਂਦੇ ਜਿਹੜੇ ਮਹੀਨਿਆਂ ਵਿੱਚ ਤਰੀਕਾਂ ਵਿੱਚ ਆਉਂਦੇ ਆ ਉਹਦੇ ਅਨੁਸਾਰ ਮਨਾਏ ਜਾਂਦੇ ਆ ਅਤੇ ਬਾਕੀ ਇਸ ਦਿਨ ਅਸੀਂ ਕੀ ਹੈ ਜਿੱਦਾਂ ਦੀਵਾਲੀ ਹੋ ਗਈ ਦੁਸਹਿਰਾ ਹੋ ਗਿਆ ਸਾਰਿਆਂ ਨੂੰ ਪਤਾ ਹੈ ਕਿ ਨਵੇਂ ਕੱਪੜੇ ਪਾਉਂਦੇ ਆ ਬਜ਼ਾਰਾਂ ਵਿੱਚ ਸ਼ੋਪਿੰਗ ਕਰਦੇ ਆ ਮਠਿਆਈਆਂ ਖਰੀਦਦੇ ਆ ਬੰਬ ਪਟਾਕੇ ਚਲਾਉਂਦੇ ਆ ਅਤੇ ਜਿਹੜੇ ਗੁਰਪੁਰਬ ਆ ਇਹਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੇ ਆ